ਧਾਗੇ ਜਾਂ ਸੂਤ ਨਾਲ ਕੱਪੜਾ ਬਣਾਉਣਾ ਜਾਂ ਉਹਨਾਂ ਨਾਲ ਸਵਾਟਰ ਆਦਿ ਬਣਾਉਣ ਨੂੰ ਕਹਿੰਦੇ ਹਨ ਇਹ ਇੱਕ ਦੇ ਬਾਅਦ ਇੱਕ ਫੰਦੇ ਲਗਾ ਕੇ ਕੀਤਾ ਜਾਂਦਾ ਹੈ ਫੰ ਪੁਰਾਣੇ ਫੰਦਿਆਂ ਦੇ ਨਵੇਂ ਨਵੇਂ ਕੱਢੇ ਜਾਂਦੇ ਹਨ ਨਵੀਆਂ ਕਤਾਰਾਂ ਤਿਆਰ ਕੀਤੀਆਂ ਜਾਂਦੀਆਂ ਹਨ ਫੰਦਿਆਂ ਨੂੰ ਸਲਾਈ ਦੇ ਸਹਾਰੇ ਵਿਗੜਨ ਤੋਂ ਰੋਕਿਆ ਜਾਂਦਾ ਹੈ ਅਤੇ ਨਾਲ ਹੀ ਇਹਨਾਂ ਨੂੰ ਨਵੇਂ ਫੰਦੇ ਲਗਾ ਦਿੱਤੇ ਜਾਂਦੇ ਹਨ ਤਾਂ ਸਲਾਈ ਕ ਸਲਾਈ ਕੱਢ ਦਿੱਤੀ ਜਾਂਦੀ ਹੈ ਇਸ ਪ੍ਰਕਾਰ ਆਖਰ ਕਪ ਕੱਪੜਾ ਬਣ ਜਾਂਦਾ ਹੈ ਬੁਣਾਈ ਹੱਥ ਨਾਲ ਕੀਤੀ ਜਾਂਦੀ ਹੈ ਅਤੇ ਮਸ਼ੀਨ ਨਾਲ ਵੀ ਕੀਤੀ ਜਾਂਦੀ ਆ ਹੱਥ ਨਾਲ ਬੁਣਾਈ ਦੀਆਂ ਅਨੇਕਾਂ ਸ਼ੈਲੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਮੈਂ ਹੋਰ ਬਿਹਤਰ ਬਣਾਉਣ ਲਈ ਸ਼ੈਲੀਆਂ ਸਲਾਈਆਂ ਖਰੀਦਦੀ ਰਹਿੰਦੀ ਹਾਂ ਕਦੇ ਕੱਪੜੇ ਮੈਨੂੰ ਬਹੁਤ ਸ਼ੌਕ ਹੈ ਕਦੇ ਕੱਪੜੇ ਦਾ ਪਰਸ ਬਣਾਉਣ ਦਾ ਕਦੇ ਸਿਰ੍ਹਾਣੇ ਬਣਾਉਣ ਦਾ ਪਸ਼ਮ ਨਾਲ ਬਹੁਤ ਹੋਰ ਕੁਝ ਬਣ ਸਕਦਾ ਹੈ ਜਿਵੇਂ ਕਿ ਸਵਾਟਰ ਕੋਟੀਆਂ ਸ਼ਰੱਘ ਜਾਕਟਾਂ ਹੋਰ ਬਹੁਤ ਕੁਛ ਅਨੇਕਾਂ ਪ੍ਰਕਾਰ ਦੇ ਉਹਨਾਂ ਨਾਲ ਉਹ ਕੀਤੇ ਮਸ਼ੀਨਾਂ ਨਾਲ ਤਿਆਰ ਕੀਤੇ ਜਾਂਦੇ ਹਨ ਮੈਂ ਸੈਲ ਮੈਂ ਸੈਲ ਦੇ ਨਾਲ ਸੈਲ ਦੇ ਨਾਲ ਬਹੁਤ ਸੋਹਣੇ ਸੋਹਣੇ ਢੰਗਾਂ ਦੇ ਕਰਟਨ ਵਗੈਰਾ ਸਿਰ੍ਹਾਣੇ ਵਗੈਰਾ ਬਣਾਉਣੇ ਪਸੰਦ ਕਰਦੀ ਹਾਂ ਮੈਨੂੰ ਇਹਨਾਂ ਚੀਜ਼ਾਂ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਕ ਰਿਹਾ ਹੈ